ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਯੈੱਸ ਸਰ

ਅੱਛਾ ਟਿਕਟ ਬੁਕਿੰਗ ਕਰਾਉਣੀ ਹੈ ਹਾਂਜੀ ਹਾਂਜੀ ਕਰਾਦਾ ਕਰ ਦੇਵਾਂਗੇ ਜੀ ਹਾਂਜੀ ਟਰੇਨ ਤਾਂ ਜੀ ਇੱਕ ਜਾਂਦੀ ਸਵੇਰੇ ਦੋ ਵਜੇ ਇੱਕ ਜਾਂਦੀ ਪੰਜ ਵਜੇ ਇੱਕ ਦਿਨੇ ਬਾਰ੍ਹਾਂ ਵਜੇ ਅਤੇ ਇੱਕ ਸ਼ਾਮੀ ਪੰਜ ਵਜੇ ਤੁਸੀਂ ਇਹ ਸਰ ਬਠਿੰਡੇ ਵਾਇਆ ਜਾਂਦੀ ਹੈ ਹਾਂਜੀ ਹਾਂਜੀ ਉਹ ਵੀ ਜਾਂਦੀ ਹੈ ਜੀ ਇਹ ਤਾਂ ਸਾਰੀਆਂ ਬੱਸਾਂ ਦੀ ਅਲੱਗ ਅਲੱਗ ਹੈ ਸਾਰੀ ਟ੍ਰੇਨਾਂ ਦੀ ਹਾਂਜੀ ਫਾਜ਼ਿਲਕਾ ਫਿਰੋਜ਼ਪੁਰ ਹਾਂਜੀ ਫਿਰੋਜ਼ਪੁਰ ਅੰਮ੍ਰਿਤਸਰ ਇਹ ਸਿੱਧਾ ਜਾਂਦੀ ਹੈ ਜੀ ਸਵੇਰੇ ਪੰਜ ਵਜੇ ਲਗਭਗ ਚਾਰ ਤੋਂ ਪੰਜ ਘੰਟੇ ਤੱਕ ਲੱਗ ਜਾਂਦੇ ਨੇ

ਇਹ ਮਤਲਬ ਫਾਜ਼ਿਲਕਾ ਤੋਂ ਚੱਲੀ ਫਾਜ਼ਿਲਕਾ ਤੋਂ ਫੇਰ ਜਲਾਲਾਬਾਦ ਰੁਕਦੀ ਜਾਂਦੀ ਹੈ ਰੁੱਕ ਰੁੱਕ ਕੇ ਜਾਂਦੀ ਹੈ ਤਾਂ ਹੀਂ ਟਾਈਮ ਥੋੜ੍ਹਾ ਜ਼ਿਆਦਾ ਲੱਗ ਜਾਂਦਾ ਬ ਬਾਰ੍ਹਾਂ ਬਾਰ੍ਹਾਂ ਵਜੇ ਵਾਲੀ ਐਕਸਪ੍ਰੈੱਸ ਜਾਂਦੀ ਹੈ ਫੇਰ ਤਾਂ ਜੀ ਫਾਸਟ ਟ੍ਰੇਨ ਹੈ ਜ਼ਿਆਦਾ ਨਹੀਂ ਰੁੱਕਦੀ ਬਸ ਮੇਨ ਸ਼ਹਿਰਾਂ 'ਚ ਰੁਕੇਗੀ ਜਿਵੇਂ ਜਲਾਲਾਬਾਦ ਰੁਕੀ ਫੇਰ ਉਹ ਉਹ ਅੱਗੇ ਹਾਂਜੀ ਟਾਈਮ ਦਾ ਵੀ ਫਰਕ ਪੈ ਜਾਵੇਗਾ ਬਹੁਤ ਸਾਢੇ ਤਿੰਨ ਘੰਟੇ ਤੱਕ ਲਾ ਦਿੰਦੀ ਤਿੰਨ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਕਰ ਦਿੰਦੇ ਹੈ ਜੀ ਉਹਦਾ ਕਿਰਾਇਆ ਹੈ ਜੀ ਡੇਢ ਸੌ ਉਹਦਾ ਉਹ ਰੁੱਕ ਰੁੱਕ ਕੇ ਜਾਂਦੀ ਹੈ ਜੀ ਉਹਦਾ ਥੋੜ੍ਹਾ ਫਰਕ ਹੈ ਜੀ ਉਹਦਾ ਇੱਕ ਸੌ ਸੱਤਰ ਰੁਪਏ ਹੈ ਇੱਕ ਸੌ ਤੀਹ ਰੁਪਏ

ਉਹਦਾ ਇੱਕ ਸੌ ਅੱਸੀ ਰੁਪਏ ਠੀਕ ਠੀਕ ਹੈ ਕੀ ਨਾਮ ਤੁਹਾਡਾ ਸ਼ੁੱਭ ਨਾਮ ਠੀਕ ਹੈ ਜੀ ਬਾਰ੍ਹਾਂ ਵਜੇ ਵਾਲੀ

ਠੀਕ ਹੈ ਜੀ ਓਕੇ ਸਰ ਧੰਨਵਾਦ